ਹੈਲੋ

ਸਤਿ ਸ਼੍ਰੀ ਅਕਾਲ ਮੈਮ ਤੁਸੀਂ ਸਿਮਰਨ ਬੋਲ ਰਹੇ ਹੋ ਹਾਂ ਤੁਹਾਡੀ ਲੱਸੀ ਦੀ ਸ਼ੋਪ ਹੈ ਓਕੇ ਮੈਂ ਤੁਹਾਡਾ ਵਲੋਗ ਦੇਖਿਆ ਸੀਗਾ ਕਿ ਬਹੁਤ ਦੂਰੋਂ ਦੂਰੋਂ ਤੁਹਾਡੇ ਕੋਲੇ ਲੱਸੀ ਪੀਣ ਲਈ ਆਉਂਦੇ ਨੇ ਹਾਂਜੀ ਅਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਤੁਹਾਡੇ ਕੋਲ ਲੱਸੀ ਦੇ ਕਿਹੜੇ ਕਿਹੜੇ ਫਲੇਵਰ ਅਵੇਲੇਬਲ ਨੇ ਓਕੇ ਮੈਂ ਸੰਗਰੂਰ ਆਈ ਹੋਈ ਸੀਗੀ ਅਤੇ ਮੇਰੇ ਦਿਲ ਦੇ ਵਿੱਚ ਬੜੀ ਇੱਛਾ ਹੋ ਰਹੀ ਸੀਗੀ ਮੈਂ ਤੁਹਾਡੀ ਸ਼ੋਪ 'ਤੇ ਵਿਜਿਟ ਕਰਨ ਆਵਾਂ ਹਾਂਜੀ ਅਤੇ ਤੁਸੀਂ ਮੈਨੂੰ ਪ੍ਰਾਈਸਿਸ ਦੱਸ ਸਕਦੇ ਹੋ ਕਿ ਕੀ ਕੀ ਪ੍ਰਾਈਜ ਰਹਿਣਗੇ ਓਕੇ ਅਤੇ ਇੱਕ ਵਾਰ ਤੁਸੀਂ ਮੈਨੂੰ ਐਡਰੈਸ ਕਨਫਰਮ ਕਰ ਦੇਵੋਗੇ ਕਿ ਤੁਹਾਡਾ ਐਡਰੈਸ ਕੀ ਪਵੇਗਾ

ਓਕੇ ਠੀਕ ਅਤੇ ਆਹ ਲੱਸੀ ਤੋਂ ਇਲਾਵਾ ਹੋਰ ਕੁਝ ਵੀ ਹੁੰਦਾ ਤੁਹਾਡੇ ਕੋਲੇ ਓਕੇ ਠੀਕ ਏ ਹੋਰ ਹੋਰ ਕੁਛ ਤੁਸੀਂ ਦੱਸ ਦਿਓ ਪੈਕ ਕਰਵਾ ਕੇ ਤਾਂ ਉਹ ਥੋੜ੍ਹੀ ਮੈਸੀ ਨਹੀਂ ਹੋ ਜਾਵੇਗੀ

ਓਕੇ ਮਤਲਬ ਆਪਾਂ ਉਹਨੂੰ ਸਟੋਰ ਕਿੰਨੇ ਕੁ ਟਾਈਮ ਤੱਕ ਕਰ ਸਕਦੇ ਹਾਂ ਓਕੇ ਠੀਕ ਆ ਮੈਮ ਓਕੇ